ਸਾਡੇ ਭਾਰਤ ਦਾ ਮਸ਼ਹੂਰ ਤਿਉਹਾਰ ਹੈ ਇਸ ਇਹ ਸੱਭਿਆਚਾਰ ਤਿਉਹਾਰ ਨੂੰ ਮਨਾਉਣ ਲਈ ਘਰ ਵਿੱਚ ਕਈ ਦਿਨਾਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਇਸ ਦਿਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਘਰਾਂ ਵਿੱਚ ਸਫਾਈਆਂ ਹੋਰ ਵੀ ਕਈ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਦਿਨ ਲੋਕ ਆਪਣੇ ਘਰਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਉਂਦੇ ਹਨ ਲੜੀਆਂ ਲਾਉਂਦੇ ਹਨ ਹੋਰ ਰੰਗੋਲੀ ਵਗੈਰਾ ਬਣਾਉਂਦੇ ਹਨ ਅਤੇ ਉਹ ਬਜ਼ਾਰਾਂ ਵਿੱਚ ਜਾਂਦੇ ਨੇ ਬਸ ਸ਼ੋਪਿੰਗ ਕਰਦੇ ਹਨ ਅਤੇ ਉਸ ਦਿਨ ਬਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ ਲੋਕ ਬਜ਼ਾਰਾਂ ਵਿੱਚੋਂ ਪਟਾਕੇ ਦੀਵੇ ਅਤੇ ਮਾਤਾ ਜੀ ਦੀ ਫੋਟੋ ਹੋਰ ਵੀ ਬਹੁਤ ਕੁਛ ਲੈਂਦੇ ਹਨ ਉਸ ਦਿਨ ਬਜ਼ਾਰਾਂ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੁੰਦੀ ਹੈ ਉਸ ਦਿਨ ਦਿਵਾਲੀ ਵਾਲੇ ਦਿਨ ਲੋਕ ਕਾਫੀ ਚਾਅ ਹੁੰਦਾ ਕਾਫੀ ਉਤਸਾਹ ਹੁੰਦਾ ਉਸ ਦਿਨ ਲੋਕ ਪਟਾਕੇ ਚਲਾਉਂਦੇ ਹਨ ਅਤੇ ਦੀਵੇ ਜਲਾਉਂਦੇ ਹਨ ਕਾਫੀ ਧੂਮ ਧਾਮ ਨਾਲ ਉਹ ਤਿਉਹਾਰ ਮਨਾਉਂਦੇ ਹਨ ਅਤੇ ਲੋਕ ਕਾਫੀ ਖੁਸ਼ ਹੁੰਦੇ ਹਨ ਉਹ ਤਿਉਹਾਰ ਮਨਾ ਕੇ